ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਅਤੇ ਐਰੋਬਿਕ ਪੱਛਮੀ ਸੱਭਿਅਤਾ ਨਾਲ ਜੁੜੀ ਹੋਈ ਇੱਕ ਤਰ੍ਹਾਂ ਦੀ ਕਸਰਤ ਹੈ ਭੰਗੜਾ ਕਰਨ ਲਈ ਮਨ ਵਿੱਚ ਖੁਸ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਐਰੋਬਿਕ ਕਰਨ ਸਮੇਂ ਵੀ ਮਨ ਦਾ ਖੁਸ਼ ਹੋਣਾ ਜ਼ਰੂਰੀ ਹੈ ਭੰਗੜਾ ਕਰਨ ਨਾਲ ਸਰੀਰ ਹਰਕਤ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਐਰੋਬਿਕ ਕਰਨ ਸਮੇਂ ਵੀ ਸਰੀਰ ਦਾ ਇੱਕ ਇੱਕ ਅੰਗ ਹਰਕਤ ਵਿੱਚ ਆਉਂਦਾ ਹੈ ਭੰਗੜਾ ਕਰਨ ਲਈ ਸੰਗੀਤ ਦਾ ਹੋਣਾ ਜ਼ਰੂਰੀ ਹੈ ਇਸੇ ਤਰ੍ਹਾਂ ਐਰੋਬਿਕ ਕਰਨ ਲਈ ਵੀ ਸੰਗੀਤ ਦਾ ਹੋਣਾ ਬਹੁਤ ਜ਼ਰੂਰੀ ਹੈ ਭੰਗੜਾ ਪੰਜਾਬ ਵਿੱਚ ਪਾਇਆ ਜਾਂਦਾ ਹੈ ਅਤੇ ਐਰੋਬਿਕ ਪੱਛਮ ਵਿੱਚ ਕਸਰਤ ਦੇ ਤੌਰ 'ਤੇ ਕੀਤਾ ਜਾਂਦਾ ਹੈ